ਤੁਸੀਂ ਪ੍ਰਭਜੋਤ ਕੌਰ ਗੱਲ ਕਰ ਰਹੇ ਹੋ ਜੀ ਅਤੇ ਮੈਨੂੰ ਨਾ ਮੇਰੀ ਫਰੈਂਡ ਨੇ ਐਕਚੁਅਲੀ ਤੁਹਾਡਾ ਨੰਬਰ ਤੁਸੀਂ ਪਟਿਆਲੇ ਰਹਿੰਦੇ ਹੋ ਐਕਚੁਅਲੀ ਨਾ ਮੈਨੂੰ ਪਟਿਆਲੇ 'ਚ ਵਿਜਿਟ ਕਰਨੀ ਸੀ ਹਾਂ ਮੈਨੂੰ ਨਾ ਐਨਾ ਪਤਾ ਨਹੀਂ ਨਾ ਮੈਂ ਰੋਪੜ ਤੋਂ ਹਾਂ ਐਕਚੁਅਲੀ ਨਾ ਮੈਨੂੰ ਗੁਰੂਦੁਆਰਾ ਸਾਹਿਬ ਵਿਜਿਟ ਕਰਨਾ ਸੀ ਹਾਂਜੀ ਹਾਂਜੀ ਨਹੀਂ ਨੀ ਐਕ ਮੈਂ ਗੁਰੂਦੁਆਰਾ ਸਾਹਿਬ ਵੀ ਵਿਜਿਟ ਕਰਨਾ ਸੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਦੱਸਿਆ ਆਪਣਾ ਟਾਈਮ ਕੱਢ ਕੇ ਥੈਂਕ ਯੂ